ਪੰਜਾਬੀ ਭਾਸ਼ਾ ਨੇ ਹੋਰ ਭਾਸ਼ਾਵਾਂ ਨੂੰ ਪ੍ਰਭਾਵਿਤ ਕਰਨ ਦਾ ਕੰਮ ਇਸ ਤਰ੍ਹਾਂ ਕੀਤਾ ਹੈ ਕਿਉਂਕਿ ਹੋਰ ਭਾਸ਼ਾਵਾਂ ਦੇ ਆਪਣੇ ਅੱਖਰਾਂ ਦੀ ਬਣਤਰ ਪੂਰੀ ਨਹੀਂ ਹੈ ਜੇਕਰ ਦੇਖਿਆ ਜਾਵੇ ਭਾਸ਼ਾਵਾਂ ਦਾ ਗਿਆਨ ਲੈਣ ਦੇ ਲਈ ਪੰਜਾਬੀ ਭਾਸ਼ਾ ਦੇ ਵਿੱਚ ਸਾਰੇ ਅੱਖਰ ਪੂਰੇ ਹਨ ਜਦੋਂ ਵੀ ਅਸੀਂ ਪੰਜਾਬੀ ਦੇ ਵਿੱਚ ਕੁਝ ਲਿਖਦੇ ਹਾਂ ਤਾਂ ਉਹਦਾ ਅਰਥ ਕਰਨ ਦੇ ਲਈ ਸਾਨੂੰ ਬਹੁਤੇ ਸ਼ਬਦਾਂ ਦੀ ਲੋੜ ਨਹੀਂ ਪੈਂਦੀ ਸੌਖਾ ਹੀ ਸਹਿਜ ਦੇ ਨਾਲ ਇਸ ਨੂੰ ਸਮਝਿਆ ਜਾ ਸਕਦਾ ਹੈ ਜਦੋਂ ਕਿ ਇਸ ਦੇ ਉਲਟ ਅੰਗਰੇਜ਼ੀ ਜਾਂ ਹੋਰ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਦੇ ਇੱਕ ਅੱਖਰ ਦੇ ਬਹੁਤ ਭਾਸ਼ਾਈ ਅਰਥ ਵੀ ਲੱਗਦੇ ਹਨ ਪਰ ਪੰਜਾਬੀ ਦੇ ਅੰਦਰ ਐਸਾ ਕੁਛ ਨਹੀਂ ਹੈ ਇਸ ਨੂੰ ਸਿੱਖਣਾ ਔਰ ਸਮਝਣਾ ਬਹੁਤ ਸੌਖੀ ਔਰ ਸਹਿਜ ਗੱਲ ਹੈ ਅਤੇ ਇਹਨੂੰ ਸਿੱਖਿਆ ਬਹੁਤ ਸੌਖਿਆ ਜਾ ਸਕਦਾ ਹੈ